ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਮਹੱਤਤਾ ਬੇਹੱਦ ਵੱਡੀ ਹੈ ਕਿਉਂਕਿ ਇਹ ਸਿਰਫ ਇੱਕ ਨਾਚ ਨਹੀਂ ਬਲਕਿ ਪੰਜਾਬ ਦੀ ਆਤਮਾ ਇਤਿਹਾਸ ਅਤੇ ਵਿਰਾਸਤ ਨੂੰ ਦਰਸਾਉਂਦਾ ਹੈ ਭੰਗੜਾ ਆਉਣ ਵਾਲੀ ਕਿਸੇ ਵੀ ਖੁਸ਼ੀ ਨੂੰ ਮਨਾਉਣ ਦਾ ਇੱਕ ਮਹੱਤਵਪੂਰਨ ਢੰਗ ਹੈ ਜੋ ਕਿ ਪੰਜਾਬੀ ਲੋਕਾਂ ਦੀ ਉਤਸਾਹ ਪੂਰਨ ਅਤੇ ਖੁਸ਼ ਮਿਜ਼ਾਜ ਫਿਤਰਤ ਨੂੰ ਪ੍ਰਗਟ ਕਰਦਾ ਹੈ ਇਹ ਨਾਚ ਵਿਆਹ ਸ਼ਾਦੀਆਂ ਤਿਉਹਾਰਾਂ ਗੁਰ ਪੂਰਬਾਂ ਪਰੰ ਪੰਥਕ ਅਤੇ ਸਾਂਝੇ ਸਮਾ ਸਮਾਗਮਾਂ ਵਿੱਚ ਬਹੁਤ ਜੋਸ਼ ਅਤੇ ਖੁਸ਼ੀ ਨਾਲ ਕੀਤਾ ਜਾਂਦਾ ਹੈ ਪੰਜਾਬੀ ਮਿੱਟੀ ਵਿੱਚ ਭੰਗੜੇ ਦੀ ਜੜ ਬਹੁਤ ਪੁਰਾਤਨ ਹੈ ਅਤੇ ਇਹ ਖੇਤੀਬਾੜੀ ਨਾਲ ਡੂੰਘੀ ਜੁੜੀ ਹੋਈ ਹੈ ਮੌਸਮ ਫਸਲਾਂ ਦੀ ਕਟਾਈ ਅਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਜਦੋਂ ਆਪਣੇ ਮੁਕੰਮਲ ਉਤਪਾਦ ਦੀ ਖੁਸ਼ੀ ਮਨਾਉਂਦੇ ਹਨ ਤਾਂ ਉਹ ਗੀਤ ਗਾਉਂਦੇ ਹਨ ਅਤੇ ਭੰਗੜਾ ਪਾਉਂਦੇ ਹਨ ਇਹ ਇੱਕ ਪ੍ਰਕਿਰਿਆ ਸੀ ਜੋ ਕਿ ਕੰਮ ਤੋਂ ਬਾਅਦ ਆਰਾਮ ਮਨੋਰੰਜਨ ਅਤੇ ਸਰੀਰਕ ਉਤਸਾਹ ਨੂੰ ਵਧਾਉਣ ਲਈ ਕੀਤੀ ਜਾਂਦੀ ਸੀ ਇਸ ਦੇ ਅੰਦਰ ਭਰੀਆਂ ਉਤਸ਼ਾਹ ਪੂਰਨ ਗਤੀਵਿਧੀਆਂ ਹੁੰਦੀਆਂ ਹਨ ਜਿਹਨਾਂ ਵਿੱਚ ਉੱਚੀ ਉੱਚੀ ਛਾਲਾਂ ਜ਼ੋਰਦਾਰ ਹਲਚਲਾਂ ਅਤੇ ਜੋਸ਼ ਭਰੇ ਹਵਾਲੇ ਸ਼ਾਮਿਲ ਹੁੰਦੇ ਸਨ ਭੰਗੜਾ ਕਰਦੇ ਸਮੇਂ ਪੰਜਾਬੀ ਲੋਕਾਂ ਦੀ ਖੁਸ਼ੀ ਅਤੇ ਆਤਮ ਵਿਸ਼ਵਾਸ ਦਿਸਦਾ ਹੈ ਜੋ ਕਿ ਉਹਨਾਂ ਦੀ ਮਜ਼ਬੂਤ ਆਤਮਾ ਅਤੇ ਚੰਗੀ ਤੰਦਰੁਸਤੀ ਦਾ ਪ੍ਰਤੀਕ ਹੈ ਸਮੇਂ ਦੇ ਨਾਲ ਭੰਗੜਾ ਸਿਰਫ ਪਿੰਡਾਂ ਅਤੇ ਖੇਤਾਂ ਤੱਕ ਹੀ ਸੀਮਿਤ ਨਹੀਂ ਰਿਹਾ ਬਲਕਿ ਇਹ ਸ਼ਹਿਰੀ ਜ਼ਿੰਦਗੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਇੱਕ ਮਹੱਤਵਪੂਰਨ ਕਲਾ ਰੂਪ ਵਜੋਂ ਉਭਰਿਆ ਗਿਆ ਅੱਜ ਭੰਗੜੇ ਦੀ ਲੋਕਪ੍ਰਿਅਤਾ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ ਵਿਦੇਸ਼ਾਂ ਵਿੱਚ ਵੀ ਪੰਜਾਬੀ ਭਾਈਚਾਰੇ ਨੇ ਭੰਗੜੇ ਨੂੰ ਆਪਣੀ ਪਛਾਣ ਬਣਾਇਆ ਹੈ ਕਈ ਦੇਸ਼ਾਂ ਵਿੱਚ ਭੰਗੜਾ ਕੰਪੀਟੀਸ਼ਨ ਅਕੈਡਮੀਆਂ ਅਤੇ ਵਿਧਾਇਕ ਪੱਧਰ 'ਤੇ ਵੀ ਸਿੱਖਣ ਲਈ ਉਪਲਬਧ ਹੈ ਭੰਗੜੇ ਦੀਆਂ ਵੱਖ ਵੱਖ ਸ਼ੈਲੀਆਂ ਉਭਰੀਆਂ ਹਨ ਜਿਵੇਂ ਕਿ ਗਿੱਧਾ ਜੋ ਕਿ ਵਿਅਕਤੀਗਤ ਤੌਰ 'ਤੇ ਔਰਤਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਨਵੇਂ ਸਮੇਂ ਵਿੱਚ ਵਿਰਲੇ ਭੰਗੜਾ ਫਿਊਜਨ ਭੰਗੜਾ ਅਤੇ ਬੋਲੀਵੁੱਡ ਭੰਗੜਾ ਆਦਿ ਸ਼ਾਮਿਲ ਹਨ ਭੰਗੜਾ ਨਿਰੀ ਮਨੋਰੰਜਨ ਦੀ ਗਤੀਵਿਧੀ ਨਹੀਂ ਬਲਕਿ ਇੱਕ ਤੰਦਰੁਸਤੀ ਦਾ ਸਰੋਤ ਹੀ ਹੈ ਇਹ ਸਰੀਰ ਦੀ ਲਚਕਤਾ ਤਾਕਤ ਅਤੇ ਸਟੈਮੀਨਾ ਨੂੰ ਵਧਾਉਂਦਾ ਹੈ ਆਧੁਨਿਕ ਵਿਗਿਆਨ ਨੇ ਇਹ ਸਾਬਤ ਕੀਤਾ ਹੈ ਕਿ ਭੰਗੜਾ ਕਰਨ ਨਾਲ ਸਰੀਰ ਵਿੱਚ ਐਂਡੋਰਫਾਨੀ ਰਿਲੀਜ ਹੁੰਦੀ ਹੈ ਜਿਸ ਨਾਲ ਮਨੁੱਖ ਖੁਸ਼ ਮਹਿਸੂਸ ਕਰਦਾ ਹੈ ਅਤੇ ਡਿਪਰੈਸ਼ਨ ਆਦਿ ਤੋਂ ਬਚ ਸਕਦਾ ਹੈ ਇਸ ਲਈ ਭੰਗੜਾ ਹੁਣ ਵਿਆਯਾਮ ਅਤੇ ਫਿਟਨੈਸ ਦੇ ਤਰੀਕੇ ਵਜੋਂ ਵੀ ਵਰਤਿਆ ਜਾਂਦਾ ਹੈ ਪੰਜਾਬੀ ਭੰਗੜੇ ਨੇ ਬੋਲੀਵੁੱਡ ਹੋਲੀਵੁੱਡ ਅਤੇ ਵੱਖ ਵੱਖ ਅੰਤਰਰਾਸ਼ਟਰੀ ਸੰਗੀਤ ਉਦਯੋਗ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਅੱਜ ਭੰਗੜੇ ਦੇ ਬਹੁਤ ਸਾਰੇ ਗੀਤ ਸਿਨੇਮਾ ਵਿੱਚ ਵੀ ਸੁਣਨ ਨੂੰ ਮਿਲਦੇ ਹਨ ਅਤੇ ਬਹੁਤ ਸਾਰੇ ਪੱਛਮੀ ਆਪ ਅਤੇ ਹਿਪਹੋਪ ਸੰਗੀਤਕਾਰ ਦੀ ਭੰਗੜੇ ਅਤੇ ਤੱਤਾਂ ਨੂੰ ਆਪਣੇ ਗੀਤਾਂ ਵਿੱਚ ਸ਼ਾਮਿਲ ਕਰ ਰਹੇ ਹਨ ਇਹ ਸਿਰਫ ਇੱਕ ਨਾਚ ਨਹੀਂ ਬਲਕਿ ਇਹ ਪੰਜਾਬੀ ਲੋਕਾਂ ਦੀ ਰੂਹ ਅਤੇ ਉਹਨਾਂ ਦੀ ਅਸਲੀਅਤ ਹੈ